ਹਾਂ ਮੈਂ ਹਾਲ ਹੀ ਵਿੱਚ ਅਠਾਰ੍ਹਾਂ ਸਾਲ ਦੀ ਹੋ ਗਈ ਹਾਂ ਮੈਂ ਵਿੱਤੀ ਤੌਰ 'ਤੇ ਸੁਤੰਤਰ ਬਣਨ ਲਈ ਪੈਨ ਕਾਰਡ ਦੀ ਅਰਜ਼ੀ ਦੇਣਾ ਚਾਹੁੰਦੀ ਹਾਂ ਪੈਨ ਕਾਰਡ ਦੀ ਅਰਜ਼ੀ ਦੇਣ ਸਮੇਂ ਮੈਂ ਆਪਣੇ ਪਿਤਾ ਜੀ ਤੋਂ ਸਲਾਹ ਲਈ ਉਹਨਾਂ ਨੇ ਦੱਸਿਆ ਕਿ ਅਰਜ਼ੀ ਦੀ ਪ੍ਰਕਿਰਿਆ ਲਈ ਆਧਾਰ ਕਾਰਡ ਰੈਜੀਡੈਂਸ ਦੀ ਵਰਤੋ ਹੋਵੇਗੀ ਪੈਨ ਕਾਰਡ ਦੀ ਅਰਜ਼ੀ ਸੇਵਾ ਕੇਂਦਰ ਵਿੱਚ ਜਾ ਕੇ ਫਾਰਮ ਭਰਨਾ ਪਵੇਗਾ ਅਤੇ ਉੱਥੋਂ ਦੇ ਕਰਮਚਾਰੀ ਉਸ ਫਾਰਮ 'ਤੇ ਭਰੇ ਹੋਏ ਰਿਹਾਇਸ਼ੀ ਪਤੇ ਨੂੰ ਵੈਬਸਾਈਟ 'ਤੇ ਅਪਲੋਡ ਕਰ ਦੇਣਗੇ ਅਤੇ ਕੁਝ ਹੀ ਪੰਦਰ੍ਹਾਂ ਦਿਨਾਂ ਤੱਕ ਪੈਨ ਕਾਰਡ ਬਣ ਕੇ ਆ ਜਾਵੇਗਾ ਅਤੇ ਉਹ ਦਿੱਤੇ ਗਏ ਪਤੇ 'ਤੇ ਸਾਨੂੰ ਪੈਨ ਕਾਡ ਪਹੁੰਚਾ ਦੇਣਗੇ ਅਤੇ ਮੈਂ ਬੇਨਤੀ ਤੌਰ 'ਤੇ ਸੁਤੰਤਰ ਹੋ ਜਾਵਾਂਗੀ ਜਦ ਮੈਂ ਅਠਾਰ੍ਹਾਂ ਸਾਲ ਦੀ ਹੋਈ ਤਾਂ